ਹਾਂਜੀ ਸਤਿ ਸ਼੍ਰੀ ਅਕਾਲ ਜੀ ਮੈਂ ਗੁਰਵਿੰਦਰਬੀਰ ਸਿੰਘ ਬੋਲ ਰਿਹਾ ਤੁਸੀਂ ਸਤਿਗੁਰੂ ਜੀ ਟੈਕਸੀ ਸਰਵਿਸ ਤੋਂ ਗੱਲ ਕਰ ਰਹੇ ਹੋ ਅਤੇ ਕੱਲ੍ਹ ਮੈਨੂੰ ਇੱਕ ਗੱਡੀ ਦਿੱਲੀ ਰੋੜੀ ਸੈਕਟਰ ਅੱਠ ਦੇ ਵਿੱਚ ਛੱਡਣ ਗਈ ਸੀ ਜਿਸਦਾ ਨੰਬਰ ਪੀ ਬੀ ਜ਼ੀਰੋ ਵਨ ਏ ਚੁਹੱਤਰ ਤੇਰ੍ਹਾਂ ਈ ਟੀ ਓ ਸੀ ਉਹਦਾ ਡਰਾਈਵਰ ਖੁਸ਼ਵਿੰਦਰ ਸਿੰਘ ਸੀ ਬਹੁਤ ਨਾਈਸ ਪਰਸਨ ਸੀ ਅਤੇ ਬਹੁਤ ਹੀ ਉਹਨੇ ਸਹੀ ਤਰੀਕੇ ਦੇ ਨਾਲ ਗੱਡੀ ਡਰਾਈਵ ਕੀਤੀ ਹੈ ਅਤੇ ਸਾਨੂੰ ਬਹੁਤ ਜ਼ਿਆਦਾ ਕੋਪਰੇਟ ਕਰਿਆ ਰਸਤੇ ਦੇ ਵਿੱਚ ਅਸੀਂ ਕਿਤੇ ਖਾਣ ਵਾਸਤੇ ਰੁਕੇ ਅਤੇ ਉਹਨੇ ਉੱਥੇ ਵੀ ਸਾਨੂੰ ਬੜਾ ਕੋਪਰੇਟ ਕਰਿਆ ਅਤੇ ਉਹਨੂੰ ਰਸਤੇ ਦਾ ਪਤਾ ਵੀ ਨਹੀਂ ਸੀ ਪਰ ਫਿਰ ਵੀ ਉਹਨੇ ਆਪਣੇ ਮੋਬਾਈਲ ਤੋਂ ਜੀ ਪੀ ਐਸ ਲਗਾ ਕੇ ਸਾਨੂੰ ਆਪਣੇ ਘਰ ਤੱਕ ਪਹੁੰਚਾਇਆ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦਾ ਅਤੇ ਨੈਕਸਟ ਟਾਈਮ ਅਸੀਂ ਤੁਹਾਡੇ ਤੋਂ ਹੀ ਟੈਕਸੀ ਬੁਕਿੰਗ ਕਰਾਵਾਂਗੇ ਅਤੇ ਪਲੀਜ਼ ਕਿਰਪਾ ਕਰਕੇ ਤੁਸੀਂ ਖੁਸ਼ਵਿੰਦਰ ਨੂੰ ਹੀ ਸਾਡੇ ਕੋਲ ਭੇਜਿਆ ਜਾਵੇ ਮੈਂ ਤੁਹਾਡਾ ਫਿਰ ਇੱਕ ਵਾਰ ਬਹੁਤ ਬਹੁਤ ਧੰਨਵਾਦ ਕਰਦਾ ਹਾਂ